ਸਤਿ ਸ਼੍ਰੀ ਅਕਾਲ ਜੀ ਵੈਸੇ ਤਾਂ ਪੰਜਾਬੀ ਕਹਾਵਤਾਂ ਜਾਂ ਮੁਹਾਵਰੇ ਪੜ੍ਹੇ ਹੋਏ ਕਾਫੀ ਸਾਲ ਹੋ ਗਏ ਨੇ ਕਿਉਂਕਿ ਸ਼ਹਿਰਾਂ ਦੇ ਵਿੱਚ ਰਹਿੰਦੇ ਹਾਂ ਤਾਂ ਇੰਨੇ ਪੰਜਾਬੀ ਕਹਾਵਤਾਂ ਜਾਂ ਮੁਹਾਵਰੇ ਨਹੀਂ ਯੂਜ਼ ਹੁੰਦੇ ਡੇਲੀ ਲਾਈਫ ਦੇ ਵਿੱਚ ਹਾਂ ਪਰ ਪਹਿਲਾਂ ਘਰਾਂ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਸੀਗੇ ਉਹ ਕੁਝ ਨਾ ਕੁਝ ਮੁਹਾਵਰੇ ਜਾਂ ਕਹਾਵਤਾਂ ਜ਼ਰੂਰ ਪੜ੍ਹਦੇ ਰਹਿੰਦੇ ਸੀਗੇ ਹਾਂ ਉਹਨਾਂ ਦੇ ਵਿੱਚੋਂ ਮੈਨੂੰ ਕੁਝ ਕੁ ਪੰਜਾਬੀ ਮੁਹਾਵਰੇ ਯਾਦ ਨੇ ਜਿਵੇਂ ਕਿ ਉਂਗਲ ਕਰਨੀ ਉਫ ਨਾ ਕਰਨੀ ਔਖਲੀ 'ਚ ਸਿਰ ਦੇਣਾ ਇੱਦਾਂ ਦੇ ਜਿੱਥੋਂ ਤੱਕ ਪੰਜਾਬੀ ਕਹਾਵਤਾਂ ਦੀ ਗੱਲ ਕਰੀਏ ਤਾਂ ਪੰਜਾਬੀ ਕਹਾਵਤਾਂ ਸੱਚੀ ਟੋਂਟ ਮਾਰਨ ਦੇ ਵਿੱਚ ਬੜੀਆਂ ਮਜ਼ੇਦਾਰ ਹੁੰਦੀਆਂ ਸੀ ਸਭ ਤੋਂ ਪਹਿਲਾਂ ਤਾਂ ਇੱਕ ਹੁੰਦੀ ਸੀ ਜਿਹੜੀ ਮੈਨੂੰ ਯਾਦ ਹੈ ਹਾਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਵੀ ਪਹਿਲਾਂ ਤਾਂ ਤੁਸੀਂ ਪਾਪ ਕਰੀ ਗਏ ਹੁਣ ਤੁਸੀਂ ਪਸ਼ਚਾਤਾਪ ਕਰਨ ਲਈ ਰੱਬ ਦਾ ਨਾਂ ਤੁਸੀਂ ਲੈਣਾ ਸ਼ੁਰੂ ਕਰਤਾ ਹਾਂ ਇੱਕ ਹੋਰ ਹੁੰਦਾ ਸੀ ਅੱਲ੍ਹਾ ਤੁਹਾਡਾ ਯਾਰ ਤਾਂ ਬੇੜੇ ਪਾਰ ਮਤਲਬ ਜਿਹੜੇ ਦਿਨ ਜਿਹਨੇ ਰੱਬ ਨੂੰ ਹੀ ਮਨਾ ਲਿਆ ਉਹਦੇ ਤਾਂ ਆਪੇ ਹੀ ਬੇੜੇ ਤਰ ਜਾਂਦੇ ਨੇ ਇਸ ਤਰ੍ਹਾਂ ਕਈ ਕਹਾਵਤਾਂ ਅਤੇ ਮੁਹਾਵਰੇ ਨੇ ਪਰ ਉਹਨਾਂ ਦੇ ਵਿੱਚੋਂ ਮਨਪਸੰਦ ਮੇਰੇ ਇਹੀ ਨੇ ਧੰਨਵਾਦ